ਨਮਸ ਨਮਸਤੇ ਮੈਡਮ ਜੀ ਮੈਂ ਰੀਤੂ ਬਾਲਾ ਢੇਸੀਆਂ ਤੋਂ ਮੈਂ ਮਤਲਬ ਕਿ ਸਿਲਾਈ ਬੱਚੇ ਕੁੜੀਆਂ ਨੂੰ ਸਿਖਾਉਣਾ ਚਾਹੁੰਦੀ ਹਾਂ ਹਾਂਜੀ ਮੈਂ ਸਿਲਾਈ ਸਿੱਖੀ ਵੀ ਹਾਂ ਹੁਣ ਮੈਂ ਕੁੜੀਆਂ ਨੂੰ ਸਿਖਲਾਈ ਸਿਖਾਉਣਾ ਚਾਹੁੰਦੀ ਹਾਂ ਅਤੇ ਜਿਹੜੀਆਂ ਮਲਕੀ ਕੁੜੀਆਂ ਸਿਲਾਈ ਸਿੱਖ ਸਕਦੀਆਂ ਅਤੇ ਮਲਕੀ ਹਰ ਤਰੀਕੇ ਦੀ ਸਿਲਾਈ ਸਿਖਾ ਰਹੀ ਹਾਂ ਮਲਕੀ ਮੈਨੂੰ ਸਭ ਕੁਝ ਆਉਂਦਾ ਆ ਸਲਵਾਰ ਸੂਟ ਵੀ ਆਉਂਦਾ ਸਾੜੀ ਸਟਿੱਚ ਕਰਨੀ ਪੇਟੀਕੋਟ ਬਲੋਚ ਹਰ ਤਰੀਕੇ ਦੀ ਮੈਂ ਸਿਲਾਈ ਸਿਖਾਉਂਦੀ ਹਾਂ ਗਰੀਬ ਘਰ ਦੀਆਂ ਕੁੜੀਆਂ ਉਹਨਾਂ ਨੂੰ ਵੀ ਸਿਖਾਉਂਦੀ ਹਾਂ ਅਤੇ ਮੈਂ ਫਰੀ ਵਾਲੀਆਂ ਮਸ਼ੀਨਾਂ ਵੀ ਰੱਖੀ ਦੀਆਂ ਅਤੇ ਕੁੜੀਆਂ ਕੋਲ ਹੀ ਮਸ਼ੀਨਾਂ ਤੋਂ ਸਿਲਾਈ ਸਿੱਖਦੀਆਂ ਅਤੇ ਕੁੜੀਆਂ ਵੀ ਬੋਲਦੀਆਂ ਕਿ ਠੀਕ ਸਿਲਾਈ ਹੈ ਅਤੇ ਮੈਨੂੰ ਵੀ ਬੜਾ ਪਸੰਦ ਲੱਗਦਾ ਕਿ ਮੈਂ ਕੁੜੀਆਂ ਨੂੰ ਸਿਲਾਈ ਸਿਖਾਵਾਂ ਗਰੀਬ ਘਰ ਦੀਆਂ ਕੁੜੀਆਂ ਨੂੰ ਅਤੇ ਮੇਰੇ ਕੋਲ ਕੁੜੀਆਂ ਬਹੁਤ ਜ਼ਿਆਦਾ ਸਿਲਾਈ ਸਿੱਖਦੀਆਂ ਹਰ ਤਰੀਕੇ ਦੀ ਸਿਲਾਈ ਮੈਂ ਸਿਖਾਉਂਦੀ ਹਾਂ ਅਤੇ ਕੁੜੀਆਂ ਵੀ ਸਿੱਖਦੀਆਂ ਸਿਲਾਈ ਪਜਾਮੇ ਕੁੜਤੇ ਫਰਾਕਾਂ ਹਰ ਤਰੀਕੇ ਸਿਲਾਈ ਮੈਂ ਕਰਦੀ ਹਾਂ ਹਾਂਜੀ ਪਲਾਜੋ ਸੂਟ ਸਲਵਾਰ ਸੂਟ ਹਰ ਤਰੀਕੇ ਸਿਲਾਈ ਮੈਂ ਸਿਖਾਉਂਦੀ ਹਾਂ ਅਤੇ ਫਰੀ ਸਿਲਾਈ ਵੀ ਸਿਖਾਉਂਦੀ ਹਾਂ ਗਰੀਬਾਂ ਨੂੰ ਗਰੀਬ ਘਰ ਦੀਆਂ ਕੁੜੀਆਂ ਨੂੰ ਫਰੀ ਸਿਲਾਈ ਵੀ ਸਿਖਾਉਂਦੀ ਹਾਂ ਹਰ ਤਰੀਕੇ ਦੀ ਸਿਲਾਈ ਸਿਖਾਉਂਦੀ ਹਾਂ ਜਿਸ ਤਰ੍ਹਾਂ ਮਰਜ਼ੀ ਦੀ ਸਿਖਾ ਲਓ ਠੀਕ